ਛੇ ਦੋ ਪੰਜ ਅੱਠ ਚਾਰ ਅੱਠ ਤਿੰਨ ਜੀਰੋ ਜੀਰੋ ਜੀਰੋ ਜੀਰੋ ਚਾਰ ਅੱਠ ਜੀਰੋ ਜੀਰੋ ਜੀਰੋ ਅੱਠ ਜੀਰੋ ਜੀਰੋ ਜੀਰੋ ਜੀਰੋ